ਸਿੱਕਿਆਂ ਨੂੰ ਇਕੱਠਾ ਕਰਨਾ ਇੱਕ ਤਾਂ ਆਪਣੀ ਹੋਬੀ ਹੁੰਦੀ ਹੈ ਵੀ ਮਨ ਵਿੱਚ ਹੁੰਦਾ ਵੀ ਹਾਂ ਵੀ ਮੈਂ ਆਪਣੀ ਪੁਰਾਣੀ ਵਿਰਾਸਤ ਨੂੰ ਸਾਂਭ ਰਹੀ ਹਾਂ ਜਿਵੇਂ ਕਿ ਪਹਿਲਾਂ ਪੰਜ ਪੈਸੇ ਇੱਕ ਪੈਸਾ ਦੋ ਪੈਸੇ ਪੱਚੀ ਪੈਸੇ ਵੀਹ ਪੈਸੇ ਹੁੰਦੇ ਸੀ ਅੱਜ ਦੇ ਸਮੇਂ ਵਿੱਚ ਉਹ ਦੇਖਣ ਨੂੰ ਮਿਲਦੇ ਨਹੀਂ ਹੈਗੇ ਪਰ ਕੁਛ ਲੋਕ ਜਾਂ ਮੇਰੇ ਕੋਲ ਵੀ ਇਹ ਪੈਸੇ ਹੈ ਸਾਂਭੇ ਹੋਏ ਉਹਨਾਂ ਦੀ ਅਹਿਮੀਅਤ ਦਾ ਵੀ ਇਹਨਾਂ ਤੋਂ ਪਤਾ ਲੱਗਦਾ ਵੀ ਪਹਿਲੇ ਸਮੇਂ ਦੇ ਵਿੱਚ ਇਹਨਾਂ ਪੈਸਿਆਂ ਦੀ ਕਿੰਨੀ ਅਹਿਮੀਅਤ ਸੀ ਕੀ ਕੁਛ ਇਹਨਾਂ ਪੈਸਿਆਂ ਦੇ ਵਿੱਚ ਆ ਜਾਂਦਾ ਸੀ ਹੁਣ ਇਹਨਾਂ ਪੈਸਿਆਂ ਦੀ ਵੈਲਿਊ ਚਾਹੇ ਨਹੀਂ ਹੈ ਨਹੀਂ ਹੈ ਪਰ ਪਹਿਲੇ ਸਮੇਂ ਦੇ ਵਿੱਚ ਕੀ ਸੀ ਇਹਨਾਂ ਪੈਸਿਆਂ ਦੀ ਬਹੁਤ ਵੈਲਊ ਸੀ ਅਤੇ ਇੱਕ ਯਾਦ ਵੀ ਆ ਪੁਰਾਣੀ ਬਚਪਨ ਦੀ ਵੀ ਮੈਂ ਇਹਨਾਂ ਪੈਸਿਆਂ ਨੂੰ ਵਰਤਿਆ ਹੋਇਆ ਇਹਨਾਂ ਪੈਸਿਆਂ ਦੀ ਦੀਆਂ ਚੀਜ਼ਾਂ ਖਰੀਦੀਆਂ ਹੋਈਆਂ ਦੂਜਾ ਆਉਣ ਵਾਲੀ ਪੀੜ੍ਹੀ ਲਈ ਵੀ ਸ਼ਕਸ਼ੀ ਨਕਸੀ ਨਸੀਹਤ ਆ ਵੀ ਮਤਲਬ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਵੀ ਪਹਿਲੇ ਸਮੇਂ ਦੇ ਵਿੱਚ ਸਾਡੇ ਇਹ ਪੈਸੇ ਚੱਲਦੇ ਸੀ ਹੁਣ ਬੇਟਾ ਆਹ ਪੈਸੇ ਚੱਲਦੇ ਨੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਕਲਚਰ ਦੇ ਨਾਲ ਜੋੜਨ ਲਈ ਇਹਨਾਂ ਪੈਸਿਆਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਪੁਰਾਣੀਆਂ ਯਾਦਾਂ ਨੂੰ ਵਿਰਾਸਤ ਆਪਣੀ ਨੂੰ ਸਾਂਭ ਕੇ ਰੱਖਣਾ ਚਾਹੀਦਾ ਕਿ ਤਾਂ ਕਿ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਸਾਡੇ ਬਜ਼ੁਰਗਾਂ ਨੇ ਕਿਹੜੀ ਕਿਵੇਂ ਦੇ ਪੈਸੇ ਵਰਤੇ ਹੈ ਕਿਵੇਂ ਦੇ ਮਾਹੌਲ ਵਿੱਚ ਰਹੇ ਨੇ ਉਹਨਾਂ ਨੂੰ ਸਾਂਭ ਕੇ ਵੱਧ ਤੋਂ ਵੱਧ ਰੱਖਣਾ ਚਾਹੀਦਾ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ